ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਖਰੜ ਤੋਂ ਅਮਰਜੀਤ ਸਿੰਘ ਗੱਲ ਕਰ ਰਿਹਾ ਹਾਂ ਕੱਲ੍ਹ ਮੈਨੂੰ ਮੇਰੀ ਗੱਲ ਹੋਈ ਸੀ ਹੈਪੀ ਸਿੰਘ ਨਾਲ ਅਤੇ ਹੈਪੀ ਸਿੰਘ ਨੇ ਕਿਹਾ ਸੀ ਮੈਂ ਤੁਹਾਡੇ ਕੋਲ ਸਾਢੇ ਸੱਤ ਵਜੇ ਖਰੜ ਪਹੁੰਚ ਜਾਵਾਂਗਾ ਅਤੇ ਇੱਕ ਮੈਂ ਤੁਹਾਨੂੰ ਤਦੋਂ ਫ਼ੋਨ ਕਰਿਆ ਸੀ ਵੀ ਜੇ ਸਾਢੇ ਸੱਤ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਸੱਤ ਵਜੇ ਮੇਰੇ ਪਾਸ ਭੇਜ ਦਿਉ ਅਤੇ ਮੈਂ ਸਮਾਨ ਸਮੂਨ ਗੱਡੀ ਵਿੱਚ ਰੱਖ ਕੇ ਅਤੇ ਆਪਣੀ ਪੈਕਿੰਗ ਪੁਕਿੰਗ ਕਰਕੇ ਅਤੇ ਚੱਲ ਪਵਾਂਗਾ ਕਿਉਂ ਰਸਤੇ ਵਿੱਚ ਬਹੁਤ ਜ਼ਿਆਦਾ ਟਰੈਫਿਕ ਹੁੰਦੀ ਹੈ ਅਤੇ ਦਿੱਲੀ ਮੇਰੀ ਟਾਈਮ ਟੂ ਟਾਈਮ ਮੈਂ ਲੇਟ ਹੋ ਜਾਵਾਂਗਾ ਇਸ ਲਈ ਜੋ ਵੀ ਹੈ ਅਗਰ ਤੁਸੀਂ ਮੈਨੂੰ ਸਮੇਂ ਤੋਂ ਪਹਿਲਾਂ ਪਹੁੰਚਾ ਦੇਵੋਗੇ ਤਾਂ ਮੈਂ ਤੁਹਾਨੂੰ ਐਕਸਟਰਾ ਪੇਅ ਕਰ ਦੇਵਾਂਗਾ ਧੰਨਵਾਦ ਜੀ